ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਇਕਨੋਮਿਕਸ ਸਰਚਰ ਬੋਲ ਰਿਹਾ ਸੀ ਤੁਸੀਂ ਮੈਨੂੰ ਥੋੜ੍ਹੀ ਜਿਹੀ ਡਿਟੇਲ ਦੱਸ ਸਕਦੇ ਜੀ ਆਪਣੇ ਪੰਜਾਬ ਇਕਨੋਮਿਕ ਸਰਚਰ ਦੇ ਬਾਰੇ ਐਗਰੀਕਲਚਰ ਬੇਸਿਸ ਹਾਂਜੀ ਮੇਰਾ ਨਾਮ ਸਿਮਰਨਜੀਤ ਸਿੰਘ ਆ ਜੀ ਅਤੇ ਮੈਂ ਬੇਸਿਕਲੀ ਹਰਿਆਣੇ ਦਾ ਜੀ ਇਸ ਵਕਤ ਤੇ ਇਸ ਟਾਈਮ ਮੇਰੀ ਟਰਾਂਸਫਰਿੰਗ ਪਟਿਆਲੇ ਹੈ ਜੀ ਹਾਂਜੀ ਠੀਕ ਹੈ ਜੀ ਅੱਛਾ ਜੀ ਓਕੇ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਭਾਅ ਜੀ ਅਤੇ ਆਪਣੀ ਐਨੁਅਮ ਇਕੋਨ ਕਿਵੇਂ ਕਿੰਨੀ ਹੁੰਦੀ ਐਗਰੀਕਲਚਰ ਤੋਂ ਓਕੇ ਠੀਕ ਹੈ ਜੀ ਇਹ ਤੁਸੀਂ ਪਰ ਏਕੜ ਦੱਸ ਰਹੇ ਮੈਨੂੰ ਪਰ ਏਕੜ ਮਤਲਵ ਏਕੜ ਓਕੇ ਹਾਂਜੀ ਜ਼ਰੂਰ ਜੀ ਜ਼ਰੂਰ ਠੀਕ ਹੈ ਧੰਨਵਾਦ ਸਰ